ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਅਸੀਂ ਐਪਲ ਮੇਡ 'ਤੇ ਜਾ ਕੇ ਭਾਸ਼ਾ ਦਾ ਕਿਸੇ ਨਾਲ ਸੰਚਾਰ ਕਰ ਸਕਦੇ ਹਾਂ ਅਸ ਅਤੇ ਅਸੀਂ ਅਨੁਵਾਦ ਵੀ ਕੀਤਾ ਉਸ ਵਿੱਚ ਸਾਡੀ ਸੁਵਿਧਾ ਇਹ ਹੁੰਦੀ ਹੈ ਲੈਂਗੁਏਜ ਦੇ ਵਿੱਚ ਕਾਫੀ ਡਿਫਰੈਂਟ ਚੀਜ਼ਾਂ ਆ ਜਾਂਦੀਆਂ ਨੇ ਉਸ ਵਿੱਚ ਅਸੀਂ ਹਰ ਤਰ੍ਹਾਂ ਦੀ ਇੰਡੀਅਨ ਲੈਵਲ ਦੀ ਲੈਂਗੁਏਜ ਨੂੰ ਯੂਜ ਕਰਕੇ ਸਲੈਕਟ ਕਰਕੇ ਅਸੀਂ ਗੱਲਬਾਤ ਸੰਚਾਰ ਕਰ ਸਕਦੇ ਹਾਂ ਇਸ ਨਾਲ ਬਹੁਤ ਸਾਡਾ ਫਾਇਦਾ ਹੁੰਦਾ ਹੈ ਜਿਸ ਤਰ੍ਹਾਂ ਮੈਂ ਪੰਜਾਬੀ ਜਾਣਦਾ ਹਾਂ ਅਸੀਂ ਮੰਨ ਲਉ ਹਰਿਆਣਵੀ ਲੈਂਗੁਏਜ ਜਿਹੜੀ ਉਹਨਾਂ ਦਾ ਬੋਲਚਾਲ ਹੈ ਉਹ ਅਸੀਂ ਸਲੈਕਟ ਕਰਕੇ ਵਧੀਆ ਤਰੀਕੇ ਨਾਲ ਸਮਝ ਕੇ ਉਹਨਾਂ ਨਾਲ ਅਸੀਂ ਗੱਲਬਾਤ ਕਰ ਸਕਦੇ ਹਾਂ ਜੋ ਕਿ ਸਾਡੇ ਸੰਚਾਰ ਵਿੱਚ ਬਹੁਤ ਵਧੀਆ ਤਰੀਕੇ ਨਾਲ ਕੀਤੀ ਜਾਂਦੀ ਹੈ ਅਤੇ ਸਾਨੂੰ ਬਹੁਤ ਲਾਭਦਾਇਕ ਹੁੰਦੀ ਹੈ ਸਾਡੇ ਲਈ ਅਸੀਂ ਕਹਿ ਸਕਦੇ ਹਾਂ ਕਿ ਭਾਸ਼ਾ ਦਾ ਸੰਚਾਰ ਐਪ ਰਾਹੀਂ ਕਰਨ ਨਾਲ ਸਾਨੂੰ ਬਹੁਤ ਬੈਨੀਫਿਟ ਹੁੰਦਾ ਹੈ ਡਿਫਰੈਂਟ ਲੈਂਗੁਏਜ ਵਾਲੇ ਪ੍ਰਸ਼ਨ ਹਰ ਕੰਟਰੀ ਹਰ ਦੇਸ਼ ਹਰ ਸਟੇਟ ਵਿੱਚ ਰਹਿੰਦੇ ਨੇ ਅਸੀਂ ਇਸ ਐਪ ਰਾਹੀਂ ਯੂਜ ਕਰਕੇ ਅਸੀਂ ਹਰ ਤਰ੍ਹਾਂ ਦੀ ਭਾਸ਼ਾ ਸਲੈਕਟ ਕਰਕੇ ਪਰਵੇਸ਼ਨ ਕਰ ਸਕਦੇ ਹਾਂ ਅਤੇ ਐਡੀਟਿੰਗ ਕਰਕੇ ਅਸੀਂ ਆਪਣੀ ਭਾਸ਼ਾ ਨੂੰ ਆਪਣੀ ਭਾਸ਼ਾ ਵਿੱਚ ਉਹਨਾਂ ਦੀ ਗੱਲ ਸਮਝ ਕੇ ਅਸੀਂ ਉਹਨਾਂ ਦਾ ਜਵਾਬ ਦੇ ਸਕਦੇ ਹਾਂ ਅਤੇ ਆਪਣੀ ਭਾਸ਼ਾ ਉਹਨਾਂ ਨੂੰ ਉਹਨਾਂ ਦੀ ਲੈਂਗੁਏਜ ਵਿੱਚ ਟਰਾਂਸਲੇਸ਼ਨ ਕਰਕੇ ਉਹਨਾਂ ਨੂੰ ਅਸੀਂ ਸਮਝਾ ਸਕਦੇ ਹਾਂ ਇਸ ਨਾਲ ਸਾਡਾ ਗੱਲਬਾਤ ਦਾ ਤਰੀਕਾ ਇੱਕ ਦੂਜੇ ਨੂੰ ਸਾਨੂੰ ਸਮਝ ਲੱਗ ਜਾਂਦਾ ਹੈ ਜੋ ਕਿ ਸਾਡੇ ਲਈ ਬਹੁਤ ਲਾਭਦਾਇਕ ਅਤੇ ਫਾਇਦੇਮੰਦ ਹੈ